ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਰਕਰ ਸ਼ੋਪ ਤੋਂ ਜੀ ਹਾਂਜੀ ਮੈ ਮੈਂ ਕੁਝ ਸਮਾਨ ਖਰੀਦਣਾ ਸੀਗਾ ਸ਼ੋਪ ਤੋਂ ਇੱਕ ਤਾਂ ਜੀ ਮੈਨੂੰ ਡਿਨਰ ਸੈੱਟ ਚਾਹੀਦਾ ਵਧੀਆ ਜੀ ਕੰਪਨੀ ਦਾ ਕਿਹੜੇ ਕਿਹੜੇ ਹੈ ਤੁਹਾਡੇ ਕੋਲ ਕੰਪਨੀ ਦੇ ਡਿਨਰ ਸੈਟ ਹਾਂ ਜਿਸ ਤਰਾਂ ਮਿਲਟਨ ਸੈਲੋ ਜਾਂ ਮਹਿਲਾ ਮਾਈਨ ਹੈ ਤੁਹਾਡੇ ਕੋਲ ਅੱਛਾ ਤੇ ਮਹਿਲਾ ਮਾਈਨਸ ਦਾ ਉਹ ਜਿਹੜਾ ਮਹਿਲਾ ਮਾਈਨ ਦਾ ਸਾਨੂੰ ਜੀ ਜਿਵੇਂ ਇੱਕ ਡਿਨਰ ਸੈੱਟ ਵਿੱਚ ਜਿਵੇਂ ਛੇ ਵੱਡੀਆਂ ਕਟੋਰੀਆ ਹੁੰਦੀਆਂ ਛੇ ਛੋਟੀਆਂ ਹੁੰਦੀਆਂ ਤੇ ਹਾਂ ਹਾਂ ਹਾਂਜੀ ਹਾਂਜੀ ਤੇ ਇਕ ਉਹ ਰਾਈਸ ਵਾਲੀ ਪਲੇਟ ਵੀ ਹੁੰਦੀ ਆ ਤੇ ਡੋਂਗੇ ਤਿੰਨ ਵੱਡੇ ਬਾਲ ਠੀਕ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਫਿਰ ਸਾਨੂੰ ਕੋਈ ਕਲਰ ਚੋਇਸ ਵੀ ਦਿਓਗੇ ਵੀ ਕਲਰ ਅੱਡ ਅੱਡ ਹੁੰਦੇ ਹੋਣੇ ਜਾਂ ਕਿਵੇਂ ਅੱਛਾ ਅੱਛਾ ਜੀ ਬੇਸ ਮਤਲਬ ਉਹਨਾਂ ਦਾ ਵਾ ਠੀਕ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਤੇ ਕੁਆਲਿਟੀ ਵਾਈਜ਼ ਅੱਛੇ ਹੋਣਗੇ ਹਾਂ ਵੀ ਜਿਵੇਂ ਕਈ ਵਾਰ ਅੱਛਾ ਜੀ ਠੀਕ ਆ ਠੀਕ ਹੈ ਹਾਂ ਕਈ ਵਾਰ ਮਤਲਬ ਆਪਣੇ ਕੋਲ ਪਲੇਟ ਨੀਚੋ ਸੁੱਟ ਵੀ ਜਾਂਦੀ ਹੱਥ ਤੋਂ ਤੇ ਵੀ ਇਨੀ ਜਲਦੀ ਟੁੱਟਣ ਵਾਲੀ ਚੀਜ਼ ਤਾਂ ਨਹੀਂ ਹੋਏਗੀ ਅੱਛਾ ਜੀ ਠੀਕ ਆ ਠੀਕ ਕਿੰਨੇ ਚ ਅੰਦਾਜ਼ਨ ਕਿੰਨੇ ਚ ਪਏਗਾ ਮਤਲਬ ਇਹ ਫੁੱਲ ਸੈਟ ਛੋਟੀਆਂ ਪਲੇਟਾਂ ਵੀ ਦੋ ਇਹ ਛੋਟੀਆਂ ਤੇ ਵੱਡੀਆਂ ਠੀਕ ਹੈ ਜੀ ਅਲੱਗ ਅਲੱਗ ਮਤਲਬ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਚਲੋ ਡਿਨਰ ਸੈਟ ਤੇ ਇੱਕ ਮੈਂ ਕੱਪ ਸੈੱਟ ਵੀ ਲੈ ਆਂਦਾ ਸੋਚ ਰਹੀ ਸੀ ਜਿਹੜੇ ਵੀ ਬਾਰਾਂ ਕੱਪ ਦਾ ਸੈਟ ਹੋਏ ਜਿਵੇਂ ਤੇ ਇਹਦੇ ਵਿੱਚ ਕੋਈ ਮਤਲਵ ਅੱਛਾ ਜੀ ਠੀਕ ਆ ਠੀਕ ਹੈ ਅੱਛਾ ਅੱਛਾ ਠੀਕ ਹੈ ਕੋਈ ਮਤਲਬ ਹੋਏਗੀ ਸਟਾਰਟਿੰਗ ਰੇਂਜ ਇਹਨਾਂ ਦੀ ਵੀ ਕੁਆਲਿਟੀ ਵਾਈਜ਼ ਵੀ ਚਲੋ ਵਧੀਆ ਹਨਾ ਠੀਕ ਆ ਠੀਕ ਆ ਬਾਰਾਂ ਕੱਪ ਦੇਓਗੇ ਨਾ ਛੇ ਦਿਓਗੇ ਨਾ ਛੇ ਸੋ ਚ ਅੱਛਾ ਅੱਛਾ ਚਲੋ ਠੀਕ ਹੈ ਠੀਕ ਹੈ ਚਲੋ ਕੋਈ ਨੀ ਜੀ ਇੱਕ ਦੋ ਦਿਨਾਂ ਤੱਕ ਮੈਂ ਦੇਖਦੀ ਆਂ ਮੈਂ ਮਤਲਬ ਜਿਵੇਂ ਦੋ ਖਰੀਦਾ ਤੁਹਾਨੂੰ ਮੈਂ ਮੇਨ ਦੱਸ ਹੀ ਦਿੱਤੀਆਂ ਜੋ ਮੈਂ ਲੈਣੀ ਆ ਤੇ ਇੱਕ ਦੋ ਚੀਜ਼ਾਂ ਚਲੋ ਹੋਰ ਛੋਟੀਆਂ ਮੋਟੀਆਂ ਹੈਗੀਆਂ ਉਹ ਫਿਰ ਤੁਹਾਡੀ ਸ਼ੋਪ ਤੇ ਆ ਕੇ ਦੇਖ ਲਾਂਗੇ ਤੇ ਅੱਛਾ ਜੀ ਠੀਕ ਆ ਠੀਕ ਹੈ ਜੀ ਤੇ ਪੂਰਾ ਵੀਕ ਹੀ ਖੁੱਲੀ ਹੁੰਦੀ ਸ਼ੋਪ ਤੁਹਾਡੀ

ਠੀਕ ਹੈ ਜੀ ਠੀਕ ਹੈ ਚਲੋ ਠੀਕ ਹੈ ਠੀਕ ਹੈ ਜੀ ਕੋਈ ਗੱਲ ਨੀ ਇੱਕ ਦੋ ਦਿਨਾਂ ਤੱਕ ਦਰਸ਼ਨ ਦਿੰਦੇ ਆ ਜੀ ਤੁਹਾਨੂੰ ਹਾਂ ਠੀਕ ਹੈ ਜੀ ਓਕੇ ਜੀ ਥੈਂਕਯੂ